ਕਾਰੋਬਾਰ ਵਿੱਚ ਮਾਰਕਿਟਿੰਗ ਦੀ ਬਹੁਤ ਹੀ ਅਹਿਮ ਭੂਮਿਕਾ ਹੈ ਕਿਉਂਕਿ ਕਾਰੋਬਾਰ ਮਾਰਕਿਟਿੰਗ ਦੇ ਥਰੂ ਹੀ ਵੱਧ ਸਕਦਾ ਹੈ ਜਿਵੇਂ ਕਿ ਅੱਜ ਕੱਲ੍ਹ ਟੈਕਨੋਲਜੀ ਦਾ ਜ਼ਮਾਨਾ ਹੈ ਫੇਸਬੁੱਕ ਇੰਸਟਾਗ੍ਰਾਮ ਗੂਗਲ ਮੈਪਸ ਐਡਸ ਵਗੈਰਾ ਨਾਲ ਆਪਾਂ ਬਹੁਤ ਹੀ ਬਹੁਤ ਵਧੀਆ ਤਰੀਕੇ ਨਾਲ ਮਾਰਕਿਟਿੰਗ ਦਾ ਕੰਮ ਕਰ ਸਕਦੇ ਹਾਂ ਜੋ ਕਿ ਆਪਣੇ ਕਾਰੋਬਾਰ ਨੂੰ ਵਧਾਉਣ ਵਿੱਚ ਬਹੁਤ ਹੀ ਜ਼ਿਆਦਾ ਸਹਾਇਕ ਹੁੰਦੀ ਹੈ ਇਸ ਲਈ ਮੈਂ ਐਕਸਪਾਇਰ ਕਰਦਾ ਹੈ ਇੰਸਟਾਗ੍ਰਾਮ ਐਡਸ ਜਿਸ ਵਿੱਚ ਆਪਾਂ ਵੱਖ ਵੱਖ ਤਰ੍ਹਾਂ ਦੀਆਂ ਆਪਣੇ ਪ੍ਰਕਾਰ ਉਦਯੋਗ ਪ੍ਰਤੀ ਦੀਆਂ ਐਡਾਂ ਪ੍ਰਦਾਨ ਕਰ ਸਕਦੇ ਹਾਂ ਜੋ ਕਿ ਹਰ ਕਿਸੇ ਮਨੁੱਖ ਲਈ ਫਾਇਦੇਮੰਦ ਰਹਿੰਦੀ ਹੈ ਜਿਸ ਨੂੰ ਹਰੇਕ ਵਧੀਆ ਚੀਜ਼ ਖਰੀਦਣ ਵਿੱਚ ਬਹੁਤ ਹੀ ਜ਼ਿਆਦਾ ਮਦਦ ਹੁੰਦੀ ਹੈ ਇਹ ਇੱਕ ਤਰ੍ਹਾਂ ਦਾ ਬਹੁਤ ਹੀ ਵਧੀਆ ਮਾਰਕਿਟਿੰਗ ਦਾ ਤਰੀਕਾ ਮੰਨਿਆ ਜਾ ਸਕਦਾ ਹੈ